ਰੂਪਨਗਰ ਦੇ ਵਿੱਚ ਬਹੁਤ ਸਾਰੀਆਂ ਏਦਾਂ ਦੀਆਂ ਸਮੱਸਿਆਵਾਂ ਨੇ ਜਿਨ੍ਹਾਂ ਨਾਲ ਲੋਕ ਕਈ ਚੀਜ਼ਾਂ ਤੋਂ ਜੂ਼ਝ ਰਹੇ ਆ ਜਿਵੇਂ ਕਿ ਬਿਜਲੀ ਦਾ ਬਹੁਤ ਟਾਇਮ ਤੋਂ ਏਦਾਂ ਹੁੰਦਾ ਹੈ ਕਿ ਬਿਜਲੀ ਦਾ ਜਿਹੜਾ ਪੂਰਾ ਪੱਕਾ ਪ੍ਰਬੰਧ ਨਹੀਂ ਕੀਤਾ ਗਿਆ ਹੈ ਅਤੇ ਲੋਕਾਂ ਨੂੰ ਗਰਮੀ ਦੇ ਵਿੱਚ ਰਹਿਣਾ ਪੈਂਦਾ ਸਰਦੀਆਂ ਦੇ ਵਿੱਚ ਇਹ ਹੁੰਦਾ ਹੈ ਕਿ ਲੋਕ ਆਪਣੇ ਘਰ ਤੋਂ ਬਾਹਰ ਬੈਠ ਜਾਂਦੇ ਹੈ ਜਾਂ ਧੁੱਪਾਂ ਲੈ ਲੈਂਦੇ ਹੈ ਅਤੇ ਗਰਮੀਆਂ ਦੇ ਵਿੱਚ ਇਹ ਹੁੰਦਾ ਹੈ ਕਿ ਬਹੁਤ ਜ਼ਿਆਦਾ ਤਪਦਾ ਹੁੰਦਾ ਹੈ ਮੌਸਮ ਵੀ ਅਤੇ ਘਰ ਦੇ ਵਿੱਚ ਅੰਦਰ ਏਦਾਂ ਬਿਨਾਂ ਪੱਖੇ ਤੋਂ ਨਹੀਂ ਬੈਠਿਆ ਜਾ ਸਕਦਾ ਹੈ ਨਾ ਸਕੂਲਾਂ ਦੇ ਵਿੱਚ ਵੀ ਕਈ ਬੱਚਿਆਂ ਨੂੰ ਇਨ੍ਹਾਂ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਗਰਮੀ ਦੀ ਵਜ੍ਹਾ ਨਾਲ ਅਤੇ ਦੂਜੀ ਗੱਲ ਇਹ ਹੈ ਕਿ ਜਿਹੜੇ ਹੋਸਪੀਟਲਸ਼ ਹੈ ਬਹੁਤ ਦੂਰ ਦੂਰ ਨੇ ਹੈ ਨਾ ਜਿੱਦਾਂ ਹੁਣ ਪਿੰਡਾਂ ਵਾਲੇ ਲੋਕ ਹੋ ਗਏ ਉਨ੍ਹਾਂ ਨੂੰ ਬੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਜਦੋਂ ਕੋਈ ਬਿਮਾਰ ਹੋ ਜਾਂਦਾ ਉਨ੍ਹਾਂ ਨੂੰ ਡਿਸ਼ਟਿਕ ਹੋਸਪੀਟਲ ਦੇ ਵਿੱਚ ਆਉਣ 'ਚ ਹੀ ਬਹੁਤ ਟਾਈਮ ਲੱਗ ਜਾਂਦਾ ਜਿਹਦੇ ਨਾਲ ਜਿਹੜਾ ਬਿਮਾਰ ਹੁੰਦਾ ਬੰਦਾ ਉਹਦੀ ਹਾਲਤ ਹੋਰ ਗੰਭੀਰ ਹੋ ਜਾਂਦੀ ਹੈ ਅਤੇ ਇਸ ਦੇ ਲਈ ਜਿਹੜਾ ਸਰਕਾਰ ਨੂੰ ਵੀ ਬਹੁਤ ਸਾਰੀਆਂ ਚੀਜ਼ਾਂ ਦਾ ਦੱਸਿਆ ਗਿਆ ਹੈ ਵੇਰਵਾ ਦਿੱਤਾ ਗਿਆ ਹੈ